ਕਿਫਾਇਤੀ ਆਵਾਜਾਈ ਦੀ ਕਾਢ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ ਅਸੀਂ ਪੇਂਡੂ ਖੇਤਰ ਵਿੱਚ ਰਹਿੰਦੇ ਹਾਂ ਜਿੱਥੇ ਆਲੇ ਦੁਆਲੇ ਘੁੰਮਣ ਲਈ ਬਹੁਤ ਸਾਰੇ ਵਿਕਲਪ ਨਹੀਂ ਹਨ ਕਈ ਵਾਰ ਸਾਨੂੰ ਨਜ਼ਦੀਕੀ ਬੱਸ ਸਟਾਪ ਜਾਂ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਹੀ ਘੰਟੇ ਤੱਕ ਪੈਦਲ ਤੁਰਨਾ ਪੈਂਦਾ ਹੈ ਇਹ ਸਾਡੇ ਲਈ ਨੇੜੇਲੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਸਿਹਤ ਦੇਖਭਾਲ ਸਿੱਖਿਆ ਜਾਂ ਨੌਕਰੀ ਦੇ ਮੌਕਿਆਂ ਤੱਕ ਪਹੁੰਚਣ ਦਾ ਬਹੁਤੇ ਔਖਾ ਕਾਰਨ ਬਣ ਜਾਂਦਾ ਹੈ ਅਸੀਂ ਅਕਸਰ ਗੈਰ ਭਰੋਸੇਯੋਗ ਅਤੇ ਮਹਿੰਗੇ ਆਵਾਜਾਈ ਦੇ ਕਾਰਨ ਮੁਲਾਕਾਤਾਂ ਕਲਾਸਾਂ ਜਾਂ ਇੰਟਰਵਿਊ ਤੋਂ ਵੱਖਰੇ ਰਹਿ ਜਾਂਦੇ ਹਾਂ ਅਸੀਂ ਇਸ ਸਥਿਤੀ ਤੋਂ ਅਲੱਗ ਖਲਲ ਅਤੇ ਨਿਰਾਸ਼ ਮਹਿਸੂਸ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਬਾਕੀ ਦੁਨੀਆਂ ਨਾਲ ਜੁੜਨ ਦਾ ਕੋਈ ਬਿਹਤਰ ਤਰੀਕਾ ਹੋਵੇ ਸਾਡੇ ਕੋਲ ਇਕ ਸਾਈਕਲ ਹੈ ਪਰ ਜਿਸ ਕਰਕੇ ਸਾਈਕਲ ਵੀ ਇੱਕ ਬਹੁਤੇ ਹੀ ਤੇਜ਼ ਵਾਹਨ ਨਹੀਂ ਹੈ ਅਤੇ ਸਾਨੂੰ ਪਹੁੰਚਣ ਵਿੱਚ ਕਈ ਥਾਵਾਂ 'ਤੇ ਬਹੁਤੇ ਹੀ ਦੇਰ ਹੋ ਜਾਂਦੀ ਹੈ